ਹਾਂਜੀ ਪੰਜਾਬ ਦੀ ਰਵਾਇਤੀ ਦੇਖੋ ਜੀ ਪੰਜਾਬ ਜਿਵੇਂ ਕਿ ਸਾਰੇ ਜਾਣਦੇ ਆ ਪੰਜਾਬ ਦੇ ਲੋਕ ਖਾਣ ਪੀਣ ਦੇ ਬੜੇ ਸ਼ੌਕੀਨ ਆ ਅਤੇ ਇੱਥੇ ਜ਼ਿਆਦਾਤਰ ਸਰਦੀਆਂ ਦੇ ਵਿੱਚ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਠੀਕ ਹੈ ਜੀ ਇਹ ਇੱਥੋਂ ਦਾ ਜਿਹਨੂੰ ਰਵਾਇਤੀ ਕਹਿ ਦਿੰਦੇ ਨਾ ਆਪਾਂ ਉਹ ਆ ਇਹ ਲੋਕ ਬਾਹਰ ਬਾਹਰੋਂ ਵੀ ਆ ਕੇ ਪੰਜਾਬ 'ਚ ਜਦੋਂ ਕੋਈ ਬਾਹਰੋਂ ਕੋਈ ਆਉਂਦਾ ਵਾ ਉਹ ਵੀ ਆ ਕੇ ਪਹਿਲਾਂ ਇੱਥੇ ਇਹੋ ਚੀਜ਼ ਖਾਂਦਾ ਸਾਗ ਮੱਕੀ ਦੀ ਰੋਟੀ ਜਲੇਬੀਆਂ ਫਿਰ ਤੁਹਾਡੇ ਕੁਲਚੇ ਛੋਲੇ ਨਿਊਟਰੀ ਕੁਲਚਾ ਅੱਛਾ ਜੀ ਅਤੇ ਤੁਹਾਡਾ ਲੱਸੀ ਦਹੀਂ ਭੱਲੇ ਨਾਨ ਇਹ ਚੀਜ਼ਾਂ ਪੰਜਾਬ ਦੀਆਂ ਫੇਮਸ ਹੈਗੀਆਂ ਜਿਹੜਾ ਲੋਕ ਬਾਹਰੋਂ ਆਉਂਦੇ ਆ ਉਹ ਆ ਕੇ ਪੁੱਜ ਕੇ ਪਹਿਲਾਂ ਜਿਵੇਂ ਹਰ ਜਗ੍ਹਾ 'ਤੇ ਤੁਸੀਂ ਤੁਹਾਨੂੰ ਪਤਾ ਹੀ ਆ ਹਰ ਜਗ੍ਹਾ ਦਾ ਵੱਖੋਂ ਵੱਖ ਹੁੰਦਾ ਵਾ ਖਾਣਾ ਪੀਣਾ ਹਰ ਸਟੇਟ ਦੀ ਵੱਖੋ ਵੱਖ ਹਰ ਰਾਜ ਦੀ ਵੱਖੋ ਵੱਖ ਹੁੰਦਾ ਕਿ ਹਰ ਰਾਜ 'ਚ ਕੁਛ ਨਾ ਕੁਛ ਜਿਹੜਾ ਉਹਨਾਂ ਦਾ ਖਾਣਾ ਪੀਣਾ ਉਹ ਵੱਖ ਅਲੱਗ ਅਲੱਗ ਹੁੰਦਾ ਵਾ ਸਾਰਿਆਂ ਦਾ ਸਾਰਿਆਂ ਦੀ ਚੀਜ਼ਾਂ ਫੇਮਸ ਹੁੰਦੀਆਂ ਉਸ ਤਰ੍ਹਾਂ ਪੰਜਾਬ ਦੇ ਵਿੱਚ ਸਰੋਂ ਦਾ ਸਾਗ ਆ ਮੱਕੀ ਦੀ ਰੋਟੀ ਹੈ ਜਲੇਬੀ ਆ ਲੱਸੀ ਆ ਦਹੀਂ ਭੱਲੇ ਆ ਨਿਊਟਰੀ ਕੁਲਚਾ ਠੀਕ ਹੈ ਕੁਲਚੇ ਛੋਲੇ